ਸਥਾਨਕ ਨਿਊਜ਼ ਚੈਨਲ ਲੋਕਲ ਚੈਨਲ ਹੁੰਦੇ ਹਨ ਉਹਨਾਂ ਵਿੱਚ ਲੋਕਲ ਨਿਊਜ਼ ਮਿਲਦੀ ਹੈ ਜਿਵੇਂ ਸਟੇਟ ਦੇ ਵੱਖਰੇ ਵੱਖਰੇ ਚੈਨਲ ਹੁੰਦੇ ਹਨ ਸਟੇਟ ਦੀ ਸਾਰੀ ਜਾਣਕਾਰੀ ਦਿੰਦੇ ਹਨ ਕੇਂਦਰ ਨਿਊਜ ਚੈਨਲ ਵਿੱਚ ਸਾਰੀ ਕੇਂਦਰ ਦੀ ਖਬਰ ਮਿਲਦੀ ਹੈ ਸਥਾਨਕ ਨਿਊਜ਼ ਚੈਨਲ ਕੇਂਦਰ ਤੋਂ ਪੂਰੀ ਤਰ੍ਹਾਂ ਅਲੱਗ ਹਨ